ਮੈਂ ਆਲੀਸ਼ਾਨ ਯਾਤਰਾ ਜੋ ਸਮਝਦਾ ਹਾਂ ਮੇਰੇ ਹਿਸਾਬ ਨਾਲ਼ ਜਿਸ ਯਾਤਰਾ ਵਿੱਚ ਤੁਸੀਂ ਖੁਸ਼ ਹੋ ਉਹੀ ਆਲੀਸ਼ਾਨ ਯਾਤਰਾ ਹੈ ਮੈਂ ਆਲੀਸ਼ਾਨ ਯਾਤਰਾ ਕਾਲਕਾ ਤੋਂ ਸ਼ਿਮਲੇ ਤੱਕ ਦੀ ਕਰੀ ਹੈ ਜੋ ਕਿ ਇੱਕ ਟੋਆਏ ਟਰੇਨ ਵਿੱਚ ਕੀਤੀ ਹੈ ਟੋਆਏ ਟਰੇਨ ਤੁਹਾਨੂੰ ਪਹਾੜਾਂ ਦੇ ਵਿੱਚ ਦੀ ਲ ਲੈ ਕੇ ਜਾਂਦੀ ਹੈ ਜੋ ਕਿ ਕਾਲਕਾ ਤੋਂ ਸ਼ਿਮਲੇ ਤੱਕ ਦੀ ਹੀ ਚੱਲਦੀ ਹੈ ਇਹ ਬਹੁਤ ਹੀ ਅਰਾਮਦਾਇਕ ਅਤੇ ਵਧੀਆ ਹੈ ਇਸ ਕਰਕੇ ਤੁਹਾਨੂੰ ਟੋਆਏ ਟ੍ਰੇਨ ਵਿੱਚ ਸਫ਼ਰ ਇੱਕ ਨਾ ਅੱਧੀ ਵਾਰ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਜੋ ਮੈਂ ਮਹਿਸੂਸ ਕੀਤਾ ਹੈ ਮੇਰੇ ਹਿਸਾਬ ਨਾਲ਼ ਸਭ ਉਹੀ ਕਰਦੇ ਹਨ